ਮੈਂ ਔਨਲਾਈਨ ਇੱਕ ਨੋਵਲ ਮੰਗਵਾਇਆ ਸੀਗਾ ਵਿਕਟਰੀ ਦਾ ਦੁਖੀਏ ਨਾਵਲ ਆ ਮੇਰਾ ਲੰਮੇ ਸਮੇਂ ਤੋਂ ਰੁਝਾਨ ਪੜ੍ਹਨ ਦਾ ਅਤੇ ਪੜ੍ਹਨ ਦੇ ਰੁਝਾਨ ਕਰਕੇ ਮੈਂ ਉਹ ਨੋਵਲ ਮੰਗਵਾਇਆ ਸੀਗਾ ਔਨਲਾਈਨ ਉਸ ਨਾਵਲ ਦੇ ਵਿੱਚ ਬਹੁਤ ਕਮਾਲ ਦੀ ਪੇਸ਼ਕਾਰੀ ਆ ਜਿਹੜਾ ਪਾਤਰ ਹੈ ਉਹਦਾ ਮੇਨ ਮੁੱਖ ਪਾਤਰ ਉਸ ਨਾਵਲ ਦਾ ਉਹ ਮਨੁੱਖ ਦੇ ਦਾਇਰੇ ਤੋਂ ਵੱਡਾ ਮਨੁੱਖ ਦੁੱਖਾਂ ਸੁੱਖਾਂ ਦੇ ਵਿੱਚ ਆ ਜਾਂਦਾ ਮਨੁੱਖ ਕਦੇ ਹੰਕਾਰ ਦੇ ਵਿੱਚ ਆ ਜਾਂਦਾ ਆ ਮਨੁੱਖ ਕਦੇ ਲੋਭ ਲਾਲਚ ਦੇ ਵਿੱਚ ਆ ਜਾਂਦਾ ਪਰ ਓਸ ਵਿਕਟਰੀ ਸਿਰਜਿਆ ਗਿਆ ਜਿਹੜਾ ਪਾਤਰ ਹੈ ਉਹ ਇਹਨਾਂ ਦੁਨਿਆਵੀਂ ਜਾਂ ਮਨੁੱਖੀ ਪ੍ਰਵਿਰਤੀਆਂ ਤੋਂ ਉੱਪਰ ਉੱਠ ਕੇ ਵਿਚਰਦਾ ਜਿਹੜਾ ਬੜਾ ਭਾਵਪੂਰਤ ਆ ਔਰ ਸਮੁੱਚੇ ਨਾਵਲ ਦੇ ਵਿੱਚ ਉਹ ਜਿਹੜਾ ਪਾਤਰ ਹੈ ਉਹ ਆਕਰਸ਼ਣ ਦਾ ਜਿਹੜਾ ਕੇਂਦਰ ਬਣਦਾ ਪਾਠਕ ਜਦੋਂ ਉਸ ਪਾਤਰ ਬਾਰੇ ਪੜ੍ਹਦਾ ਅਤੇ ਉਹ ਪਾਤਰ ਜਦੋਂ ਖੁੱਲ੍ਹ ਕੇ ਨਾਵਲ ਦੇ ਵਿੱਚ ਪ੍ਰਗਟ ਹੁੰਦਾ ਆਪਣਾ ਆਪਾ ਵਿਅਕਤ ਕਰਦਾ ਅਤੇ ਪਾਠਕ ਦੇ ਹਿਰਦੇ ਅੰਦਰ ਵੀ ਉਹਦੇ ਵਰਗਾ ਬਣਨ ਦੀ ਇੱਕ ਜਗਿਆਸਾ ਜਾਗਦੀ ਹੈ ਕਿ ਮੈਂ ਵੀ ਮਨੁੱਖੀ ਪ੍ਰਵਿਰਤੀਆਂ ਤੋਂ ਉਪਰ ਉੱਠ ਕੇ ਇੱਕ ਐਸੇ ਮਾਹੌਲ ਦੇ ਵਿੱਚ ਜੀਵਨ ਨੂੰ ਬਤੀਤ ਕਰਾਂ ਜਿੱਥੇ ਮੈਂ ਭਲਾ ਹੀ ਕਰ ਸਕਾਂ ਜਿੱਥੇ ਮੈਂ ਖੁਸ਼ੀਆਂ ਵੰਡ ਸਕਾਂ ਜਿੱਥੇ ਮੈਂ ਆਪਣੇ ਦੁੱਖਾਂ ਨੂੰ ਆਪ ਹੀ ਝਲਦਾ ਹੋਇਆ ਅੰਦਰ ਦਬਾਵਾਂ ਸੋ ਵਿਕਟਰੋ ਦਾ ਜਿਹੜਾ ਦੁਖੀਏ ਨਾਵਲ ਦੇ ਵਿੱਚ ਜਿਹੜੇ ਪਾਤਰਨ ਚਿੱਤਰਨ ਆ ਬੜਾ ਕਮਾਲ ਦਾ ਉਹਦੇ ਵਿੱਚ ਜਿਹੜੀਆਂ ਰਿਸ਼ਤੇ ਦੀਆਂ ਪੇਸ਼ਕਾਰੀਆਂ ਨੇ ਵੱਖ ਵੱਖ ਰਿਸ਼ਤੇ ਨੇ ਸਾਡੇ ਸੰਸਾਰੀ ਉਹਦੀ ਪੇਸ਼ਕਾਰੀ ਵੀ ਬੜੇ ਕਮਾਲ ਦੇ ਤਰੀਕੇ ਦੇ ਨਾਲ ਉਸ ਨੋਵਲ ਦੇ ਵਿੱਚ ਕੀਤੀ ਗਈ ਹੈ ਸੋ ਉਹ ਨਾਵਲ ਬਹੁਤ ਹੀ ਵਧੀਆ ਲੱਗਾ ਮੈਂ ਜਿਹੜਾ ਔਨਲਾਈਨ ਪ੍ਰੋਡਕਟ ਦੇ ਰੂਪ ਦੇ ਵਿੱਚ ਮੰਗਵਾਇਆ ਸੀਗਾ